ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹਾਂਜੀ ਹਾਂਜੀ ਹਾਂਜੀ ਪਛਾਣ ਲਿਆ ਓਕੇ ਅੱਛਾ ਫਤਿਹਗੜ੍ਹ 'ਚ ਨਾ ਤੂੰ ਆਪਣੇ ਫੂਡ ਦਾ ਬਲੌਗ ਬਣਾਉਣਾ ਹੈ ਠੀਕ ਹੈ ਫਤਿਹਗੜ੍ਹ ਦੇ ਸਾਹਿਬ ਦੇ ਵਿੱਚ ਨਾ ਮੇਨ ਜਿਹੜੀ ਹੈ ਸਭ ਤੋਂ ਅੱਛੇ ਵਾਲੀ ਬੇਕਰੀ ਹੈ ਨਾ ਉਹ ਹੈਗੀ ਆ ਆਪਣੀ ਭੋਲਾ ਸਵੀਟ ਭੋਲਾ ਸਵੀਟਸ ਐਂਡ ਬੇਕਰੀ ਹੈ ਬਹੁਤ ਜ਼ਿਆਦਾ ਅੱਛੀ ਹੈ ਮਤਲਬ ਹਾਈਜੀਨਿਕ ਵੀ ਬਹੁਤ ਹੈ ਔਰ ਖਾਣਾ ਵੀ ਬਹੁਤ ਜ਼ਿਆਦਾ ਟੇਸਟੀ ਹੈ ਇਹਦੇ ਵਿੱਚ ਇਹ ਪੇਸਟ੍ਰੀਜ਼ ਹੋ ਗਈਆਂ ਮੋਫਿਨਸ ਹੋ ਗਏ ਹੈ ਨਾ ਸਾਰੇ ਬਹੁਤ ਹੀ ਮਤਲਬ ਅੱਛੀ ਕੁਆਲਿਟੀ 'ਚ ਮਿਲਦੇ ਆ ਮਤਲਬ ਐਜ ਕੰਪੇਰੇਟਿਵ ਟੂ ਅਨਦਰ ਮਤਲਬ ਜਿਹੜੇ ਹੋਰ ਸ਼ੌਪਸ ਹੈ ਉਹਨਾਂ ਨਾਲੋਂ ਮਤਲਬ ਜੋ ਬਹੁਤ ਵਧੀਆ ਕੁਆਲਿਟੀ ਹੈ ਇਹਨਾਂ ਦੀ ਪ੍ਰੋਪਰ ਐਨ ਪਟਿਆਲੇ ਵਾਲੀ ਕੁਆਲਿਟੀ ਮਿਲੂਗੀ ਤੁਹਾਨੂੰ ਇੱਥੇ ਅਤੇ ਹਰ ਬਾਕੀ ਇਹਨਾਂ ਦਾ ਜਿਹੜਾ ਰੈਸਟੋਰੈਂਟ ਵੀ ਹੈਗਾ ਨਾਲ ਹੀ ਉੱਥੇ ਵੀ ਤੁਹਾਨੂੰ ਹੈ ਨਾ ਜਿਵੇਂ ਸਾਰਾ ਸਟਰੀਟ ਫੂਡ ਸਾਰਾ ਮਿਲ ਜਾਂਦਾ ਹੈ ਅਤੇ ਖਾਣਾ ਵਗੈਰਾ ਵੀ ਤੁਸੀਂ ਕ ਖਾ ਸਕਦੇ ਹੋ ਇੱਕ ਤਾਂ ਤੁਸੀਂ ਉੱਥੇ ਜਾ ਆਇਓ ਹੈ ਨਾ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਨੰਬਰ ਦੇ ਦਉਂਗੀ ਉੱਥੇ ਇੱਕ ਮੈਨੂੰ ਜਾਣਦੇ ਆ ਨਾ ਜਿਹੜੇ ਲੱਗੇ ਹੋਏ ਆ ਮੈਨੇਜਰ ਅਤੇ ਉਹ ਤੁਹਾਨੂੰ ਸਾਰਾ ਹੈਲਪ ਕਰ ਦੇਣਗੇ ਹੈ ਨਾ ਸਾਰਾ ਕਰਨ ਦੇ ਵਿੱਚ ਅਤੇ ਦੂਜੇ ਨੰਬਰ 'ਤੇ ਜੇ ਤੁਸੀਂ ਆਪਾਂ ਦੇਖੀਏ ਤਾਂ ਇੱਕ ਸ਼ਿਵ ਸ਼ਕਤੀ ਸਵੀਟਸ ਹੈ ਉਹ ਵੀ ਬਹੁਤ ਵਧੀਆ ਨੇ ਹਾਂਜੀ ਸ਼ਿਵ ਸ਼ਕਤੀ ਸਵੀਟਸ ਹੈ ਉਹ ਵੀ ਬਹੁਤ ਵਧੀਆ ਉਹਨਾਂ ਦੀਆਂ ਦੋ ਸ਼ੌਪਸ ਨੇ ਇੱਕ ਤਾਂ ਪੁਲ ਦੇ ਇੱਧਰਲੀ ਸਾਈਡ ਹੈ ਜਿੱਧਰ ਸਾਡਾ ਘਰ ਹੈ ਉੱਧਰਲੀ ਸਾਈਡ ਹੈ ਅਤੇ ਇੱਕ ਥੋੜ੍ਹਾ ਨਾ ਬੱਸ ਸਟੈਂਡ ਦੇ ਕੋਲ ਹੈ ਜਦ ਵੀ ਜਾਓਗੇ ਬੱਸ ਸਟੈਂਡ ਉੱਥੇ ਕਿਸੇ ਨੂੰ ਵੀ ਪੁੱਛ ਲਿਓ ਤੁਹਾਨੂੰ ਦੱਸ ਦੇਣਗੇ ਕਿ ਸ਼ਿਵ ਸ਼ਕਤੀ ਸਵੀਟਸ ਕਿੱਥੇ ਹੈ ਉਹਨਾਂ ਦੀ ਵੀ ਸਵੀਟਸ ਔਰ ਜਿਹੜੀਆਂ ਹਾਂਜੀ ਫੂਡ ਆਈਟਮਸ ਹੈ ਉਹ ਬਹੁਤ ਅੱਛੀ ਕੁਆਲਿਟੀ ਦੀਆਂ ਹੁੰਦੀਆਂ ਨੇ ਇਹ ਮਤਲਬ ਦੋ ਮੇਨ ਹੈ ਜੇ ਆਪਾਂ ਹੋਰ ਛੋਟੇ ਦੇਖੀਏ ਇੱਕ ਅਨੰਤ ਬੇਕਰਸ ਨੇ ਉਹ ਵੀ ਕਾਫ਼ੀ ਵਧੀਆ ਨੇ ਮਤਲਬ ਉਹਨਾਂ ਨੇ ਨਾ ਡਰਾਈ ਕੇਕ ਅਤੇ ਮੋਫਿਨਸ ਆਹ ਬਿਸਕਿਟਸ ਹੋ ਗਏ ਇਹ ਚੀਜ਼ ਬਹੁਤ ਫੇਮਸ ਹੈ ਹਾਂ ਮੈਂ ਸੈਚਡੇ ਫਰੀ ਹੋਵਾਂਗੀ ਅਜੇ ਤਾਂ ਨੀ ਮਤਲਬ ਵੀ ਹਾਂ ਹਾਂਜੀ ਹਾਂਜੀ ਤੁਸੀਂ ਫਿਰ ਜ਼ਰੂਰ ਆ ਜਾਇਓ ਤੁਸੀਂ ਮੈਂ ਤੁਹਾਡੇ ਨਾਲ ਹੀ ਚੱਲ ਪਵਾਂਗੀ ਭਾਵੇਂ ਆਪਾਂ ਅੱਛਾ ਜਿਹਾ ਬਲੌਗ ਬਣਾ ਲਵਾਂਗੇ ਵਧੀਆ ਓਕੇ ਓਕੇ ਬ ਬਾਏ